ਦੇਖੋ ਜੀ ਜ਼ਿਆਦਾਤਰ ਸਮਾਂ ਤਾਂ ਅਸੀਂ ਫਾਰਮ 'ਚ ਹੀ ਬਿਤਾਉਂਦੇ ਹਾਂ ਜਿਵੇਂ ਕਿ ਪੰਜਾਬ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫਾਰਮ ਹੈ ਜੀ ਗੈਂਆਂ ਦਾ ਫਾਰਮ ਹੋ ਗਿਆ ਸੂਰਾਂ ਦਾ ਫਾਰਮ ਹੋ ਗਿਆ ਅਤੇ ਮੁਰਗਿਆਂ ਦਾ ਫਾਰਮ ਹੋ ਗਿਆ ਜੀ ਜਿਵੇਂ ਕਿ ਅਸੀਂ ਪਿੰਡ 'ਚ ਰਹਿਣ ਕਰਕੇ ਜੀ ਸਾਡਾ ਆਪਣਾ ਗੈਂਆਂ ਦਾ ਫਾਰਮ ਹੈ ਜੀ ਇਹ ਸਾਡੇ ਲਈ ਬਹੁਤ ਹੀ ਲਾਹੇਵੰਦ ਹੈ ਜੀ ਇਸ ਨਾਲ ਜਿਵੇਂ ਕਿ ਅਸੀਂ ਚੌਵ ਚੌਵੀ ਘੰਟੇ 'ਚ ਪੰਜ ਸੱਤ ਘੰਟੇ ਕੰਮ ਕਰਦੇ ਹਾਂ ਉਸ ਨਾਲ ਇੱਕ ਤਾਂ ਅਸੀਂ ਆਪਣੇ ਸਰੀਰ ਦੀ ਗਰਮੀ ਕੱਢਦੇ ਰਹਿੰਦੇ ਹਾਂ ਜੀ ਅਤੇ ਆਪਣੀ ਸਿਹਤ ਨੂੰ ਫਿੱਟ ਰੱਖਦੇ ਹਾਂ ਜੀ ਨੰਬਰ ਦੋ ਇਹ ਸਾਡੇ ਕੋਲ ਸੋਰਸ ਆਫ਼ ਇੰਨਕਮ ਹੈ ਜੀ ਅਤੇ ਨੰਬਰ ਤਿੰਨ ਅਸੀਂ ਇਸ ਨਾਲ ਆਪਣਾ ਸੋਰਸ ਆਫ਼ ਇੰਨਕਮ ਵੀ ਕਰਦੇ ਹਾਂ ਜਿਸ ਨਾਲ ਕਿ ਸਾਨੂੰ ਪੈਸੇ ਆਉਂਦੇ ਨੇ ਹੈ ਨਾ ਥੈਂਕ ਯੂ ਜੀ